ਹੈਲੋ ਹਾਂਜੀ ਅ ਭਲਵਾਨ ਢਾਬੇ ਤੋਂ ਬੋਲ ਰਹੇ ਹੋ ਹਾਂਜੀ ਹਾਂਜੀ ਮੈਂ ਜਦੋਂ ਰਿਤੂ ਬੋਲ ਰਹੀ ਐ ਚੋਂ ਤੁਹਾਨੂੰ ਪਤਾ ਕਿ ਅਸੀਂ ਤਕਰੀਬਨ ਤੁਹਾਨੂੰ ਔਡਰ ਕਰੀਦਾ ਹੀ ਆ ਤੁਹਾਨੂੰ ਸਾਡੀ ਮਨਪਸੰਦ ਆਈਟਮ ਵੀ ਪਤਾ ਜਿਸ ਤਰ੍ਹਾਂ ਮਾਂਹ ਰਾਜਮਾਂਹ ਛੋਲੇ ਜਾਂ ਛੋਲਿਆਂ ਦੀ ਦਾਲ ਇਹ ਤੁਹਾਡੇ ਕੋਲ ਅਸੀਂ ਤਕਰੀਬਨ ਲਈਦੇ ਜਾਂ ਬਟਨ ਨਾਨ ਹੁੰਦੇ ਆ ਹਾਂ ਇੱਕ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਅਸੀਂ ਵਿੱਚ ਪਿਆਜ ਲਸਣ ਨਹੀਂ ਪਵਾਉਂਦੇ ਅਤੇ ਸਾਡੇ ਨਾ ਬਿਨਾਂ ਪਿਆਜ ਲਸਣ ਤੋਂ ਇਹੀ ਅੱਜ ਮਾਂਹ ਰਾਜਮਾਂਹ ਅਤੇ ਛੋਲਿਆਂ ਦੀ ਦਾਲ ਇਹ ਪੈਕ ਕਰਕੇ ਨਾ ਭੇਜ ਦਿਓ ਘਰ ਸਾਡੇ ਹਾਂ ਮਾਂਹ ਰਾਜਮਾਂਹ ਅਤੇ ਛੋਲਿਆਂ ਦੀ ਦਾਲ ਹਾਂ ਬਟਰ ਨਾਨ ਨਾ ਬਟਰ ਨਾਨ ਭੇਜ ਦੇਣਾ ਨਾਲ ਹਾਂ ਇੱਕ ਬਸ ਇਹੀਓ ਯਾਦ ਰੱਖਣਾ ਕਿ ਇਹ 'ਚ ਲਸਣ ਪਿਆਜ ਬਿਲਕੁਲ ਨਹੀਂ ਪਾਉਣਾ ਹਾਂਜੀ ਠੀਕ ਹੈ ਕਿੰਨੀ ਦੇਰ ਤੱਕ ਆ ਰਹੇ ਹੋ ਤੁਸੀਂ ਹਾਂ ਅੱਧੇ ਹਾਂ ਅੱਧੇ ਘੰਟੇ ਅੱਧੇ ਪੌਣੇ ਘੰਟੇ ਤੱਕ ਪਹੁੰਚਾ ਦੇਣਾ ਬਟਰ ਨਾਨ ਛੋਲਿਆਂ ਦੀ ਦਾਲ ਮਾਂਹ ਰਾਜਮਾਂਹ ਬਿਨਾਂ ਲਸਣ ਪਿਆਜ ਦਾ ਤੜਕਾ ਠੀਕ